ਹਰਜੀਤ ਨਿਜਾਮ ਵਾਲੀ ਟੈਕਸੀ ਦਾ ਡਰਾਈਵਰ ਬੋਲਦਾ ਹਾਂ ਠੀਕ ਆ ਇਹ ਮਾਤਾ ਨੂੰ ਲੈ ਕੇ ਜਾਣਾ ਦਰਬਾਰ ਸਾਹਿਬ ਅੰਮ੍ਰਿਤਸਰ ਮੈਂ ਪੁੱਛਣਾ ਚਾਹੁੰਦਾ ਕਿ ਨਾ ਦਰਬਾਰ ਸਾਹਿਬ ਬਾਕੀ ਹੋਰ ਆਉਂਦੇ ਵੀ ਜਿਹੜੇ ਗੁਰਦੁਆਰਾ ਸਾਹਿਬ ਹੋਣਗੇ ਰਸਤੇ ਦੇ ਵਿੱਚ ਜਾਂ ਨੇੜੇ ਤੇੜੇ ਦੇ ਸਾਰਿਆਂ ਦੀ ਸੈਰ ਕਰਾ ਦੀ ਸਾਰਿਆਂ ਦੇ ਦਰਸ਼ਨ ਕਰਵਾ ਦੀ ਕਰਾਉਣ ਤੋਂ ਬਾਅਦ ਘਰੋਂ ਜਿਵੇਂ ਲੈ ਜਾਏਗਾ ਉਵੇਂ ਹੀ ਮਾਤਾ ਨੂੰ ਬੜੇ ਪਿਆਰ ਨਾਲ ਘਰ ਛੱਡ ਜੀ ਵੀਰ ਬਣ ਕੇ ਅੱਛਾ ਦੂਜੀ ਇਹ ਮੈਂ ਹੁਣ ਪੁੱਛਣਾ ਚਾਹੁੰਦਾ ਬਈ ਜਿਹੜੇ ਨਗਦੀ ਆ ਤੁਹਾਡਾ ਭੁਗਤਾਨ ਆ ਉਹ ਅਸੀਂ ਨਗਦ ਕਰ ਸਕਦੇ ਹਾਂ ਨਗਦ ਕਰ ਸਕਦੇ ਭੁਗਤਾਨ ਕਿ ਤੁਸੀਂ ਬਦਲ ਗਏ ਅਤੇ ਬਈ ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਭੁਗਤਾਨ ਕਰ ਦਾਂਗੇ ਆਪਾਂ ਗੂਗਲ ਪੇਅ ਰਾਹੀਂ ਕਹੋ ਤਾਂ ਗੂਗਲ ਪੇਅ ਰਾਹੀਂ ਕਰ ਦਾਂਗੇ ਪੇਟੀਐੱਮ ਰਾਹੀਂ ਕਹੋ ਤਾਂ ਪੇਟੀਐੱਮ ਰਾਹੀਂ ਕਰ ਦਾਂਗੇ ਅਤੇ ਬਾਕੀ ਜੇ ਨਗਦ ਲੈਣੇ ਨੇ ਜਦੋਂ ਤੁਸੀਂ ਮਾਤਾ ਨੂੰ ਲੈ ਕੇ ਆਵੇਂਗਿਓ ਤਾਂ ਮੈਂ ਨਗਦ ਵੀ ਕਰ ਸਕਦਾ ਇਹ ਇਹ ਤੁਹਾਡੀ ਇੱਛਾ ਹੈ ਜਿਵੇਂ ਤੁਸੀਂ ਦ ਕਹੇਂਗਿਓ ਵੀਰ ਜੀ ਆਪਾਂ ਉੱਦਾਂ ਹੀ ਪੈਸੇ ਦੇ ਦਾਂਗੇ ਹਾਂ ਯਾਨੀ ਐ ਆ ਵੀ ਅੱਜ ਕੱਲ੍ਹ ਗੂਗਲ ਪੇ ਚਲਦਾ ਹੈ ਜ਼ਿਆਦਾ ਵੀ ਫਟਾਫਟ ਆਪਾਂ ਗੂਗਲ ਪੇ ਤੋਂ ਗੋਲੇ ਹੀ ਮਾਰਨੇ ਨੇ ਚਾਰ ਤੁਹਾਨੂੰ ਉੱਧਰ ਤੁਹਾਡੇ ਵ ਖਾਤੇ 'ਚ ਚਲੇ ਜਾਣਗੇ ਜੇ ਨਗਦ ਕਹੋ ਤਾਂ ਨਗਦ ਦੇ ਦਾਂਗੇ ਓਕੇ